ਪੰਜਾਬੀ ਗਾਇਕੀ ਦਾ ਬੁਰਾ ਪੱਖ ਇਹ ਹੈ ਕਿ ਅੱਜ ਕੱਲ੍ਹ ਬਹੁਤ ਹੀ ਵੱਡੇ ਸਿੰਗਰ ਆਪਣੇ ਗਾਣਿਆਂ ਵਿੱਚ ਨਸ਼ਿਆਂ ਨੂੰ ਲੈ ਕੇ ਸ਼ਰਾਬ ਹੁੱਕਾ ਸਿਗਰੇਟ ਬੀੜੀ ਆਦਿ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਪ੍ਰਮੋਟ ਕਰਦੇ ਹਨ ਜੋ ਕਿ ਬੱਚਿਆਂ 'ਤੇ ਬਹੁਤ ਹੀ ਬੁਰਾ ਅਸਰ ਪਾਉਂਦੇ ਹਨ ਜਿਵੇਂ ਬਹੁਤ ਸਾਰੇ ਇੱਦਾਂ ਦੇ ਗਾਣੇ ਹਨ ਜੋ ਬੱਚੇ ਸੁਣਦੇ ਹਨ ਅਤੇ ਸੁਣ ਕੇ ਉਹੀ ਕੰਮ ਕਰਨ ਦੀ ਇੱਛਾ ਉਹਨਾਂ ਦੇ ਮਨ ਵਿੱਚ ਪ੍ਰਗਟ ਹੁੰਦੀ ਹੈ ਉਹ ਇਹ ਸੋਚਦੇ ਹਨ ਕਿ ਅਗਰ ਇਹ ਗਾਣੇ ਵਿੱਚ ਹੋਇਆ ਹੈ ਤਾਂ ਇਹ ਆਪਾਂ ਆਪਣੀ ਰੀਅਲ ਲਾਈਫ ਵਿੱਚ ਕਰਾਂਗੇ ਤਾਂ ਆਪਣੇ ਆਪ ਨੂੰ ਬਹੁਤ ਹੀ ਕੂਲ ਸਮਝਾਂਗੇ ਲੇਕਿਨ ਇਹ ਬਹੁਤ ਹੀ ਗਲਤ ਹੈ ਇਸ ਨੂੰ ਖਤਮ ਕਰਨ ਲਈ ਸਾਨੂੰ ਸਿੰਗਰਸ ਜਿਹੜੇ ਹੁੰਦੇ ਨੇ ਉਹਨਾਂ ਨੂੰ ਬਹੁਤ ਹੀ ਧਾਰਮਿਕ ਬਹੁਤ ਹੀ ਰਿਐਲਿਟੀ ਬੇਸਡ ਸਿੰਗਿੰਗ ਕਰਨੀ ਚਾਹੀਦੀ ਹੈ ਨਸ਼ਿਆਂ ਨੂੰ ਲੈ ਕੇ ਅੱਜ ਕੱਲ੍ਹ ਦਾ ਯੂਥ ਬਹੁਤ ਹੀ ਖਰਾਬ ਹੋ ਰਿਹਾ ਹੈ ਜੋ ਕਿ ਬੱਚਿਆਂ 'ਤੇ ਵੀ ਬੁਰਾ ਅਸਰ ਪਾਉਂਦਾ ਹੈ ਅਤੇ ਉਹਨਾਂ ਦੇ ਘਰ ਵਾਲਿਆਂ ਲਈ ਵੀ ਬਹੁਤ ਹੀ ਬੁਰਾ ਹੈ ਜਿੱਦਾਂ ਜਿੱਦਾਂ ਬੱਚਾ ਵੱਡਾ ਹੁੰਦਾ ਜਾਂਦਾ ਹੈ ਉਹ ਨਸ਼ਿਆਂ ਵਿੱਚ ਗਾਣਿਆਂ ਕਰਕੇ ਪਈ ਜਾਂਦਾ ਹੈ ਫਿਰ ਉਹ ਨਸ਼ੇ ਕਰਨੇ ਲੱਗ ਪੈਂਦਾ ਹੈ ਉਹਨਾਂ ਨੂੰ ਆਦਤਾਂ ਲੱਗ ਜਾਂਦੀਆਂ ਨੇ ਫਿਰ ਉਹਨਾਂ ਦੇ ਘਰ ਦੇ ਪਰਿਵਾਰਿਕ ਬਹੁਤ ਹੀ ਟੈਨਸ਼ਨ 'ਚ ਆ ਜਾਂਦੇ ਹਨ ਅਤੇ ਇਸ ਨੂੰ ਖਤਮ ਕਰਨ ਲਈ ਹੀ ਸਿੰਗਰਸ ਨੂੰ ਆਪਣੇ ਆਪ ਬੜਾ ਹੀ ਯੋਗਦਾਨ ਪਾਉਣਾ ਚਾਹੀਦਾ ਹੈ ਉਹ ਆਪਣੇ ਧਾਰਮਿਕ ਗਾਣੇ ਕੱਢ ਸਕਦੇ ਹਨ ਜਾਂ ਫਿਰ ਕੋਈ ਇੱਦਾਂ ਦਾ ਜੋ ਬੱਚਿਆਂ ਨੂੰ ਜਾਂ ਵੱਡਿਆਂ ਨੂੰ ਬਜ਼ੁਰਗਾਂ ਨੂੰ ਪਸੰਦ ਆਵੇ ਜੋ ਸਭ ਨੂੰ ਪਸੰਦ ਆਵੇ ਉਹ ਗਾਇਕੀ ਕਰਨੀ ਚਾਹੀਦੀ ਹੈ ਨਸ਼ਿਆਂ ਤੋਂ ਦੂਰ ਰਹਿ ਕੇ ਕੋਈ ਇੱਦਾਂ ਦਾ ਗਾਣਾ ਗਾਓ ਤਾਂ ਕਿ ਤੁਹਾਡਾ ਗਾਣਾ ਵੀ ਵਧੀਆ ਜਾਵੇ ਬੱਚੇ ਵੀ ਤੁਹਾਡੇ ਤੋਂ ਇਮਪਰੈਸ ਹੋਣ ਵੱਡੇ ਬਜ਼ੁਰਗ ਜੋ ਆਪਣੇ ਬੱਚਿਆਂ ਤੋਂ ਦੁਖੀ ਹਨ ਉਹ ਸਹੀ ਹੋਣ ਉਹ ਗਾਣਾ ਸੁਣ ਕੇ ਅਤੇ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਪੰਜਾਬੀ ਗਾਇਕੀ ਦਾ ਬੁਰਾ ਪੱਖ ਇਹੀ ਹੈ ਕਿ ਉਹ ਸ਼ਰਾਬੀ ਨਸ਼ਿਆਂ ਵਿੱਚ ਪੈ ਗਏ ਹਨ ਹੁੱਕਾ ਸਿਗਰੇਟ ਬੀੜੀ ਤੰਬਾਕੂ ਇਹ ਸਾਰਾ ਗਾਣਿਆਂ ਦੇ ਵਿੱਚ ਬੋਲਣਾ ਸ਼ੁਰੂ ਕਰ ਦਿੱਤਾ ਅੱਜ ਕੱਲ੍ਹ ਤਾਂ ਅੱਜ ਕੱਲ੍ਹ ਤਾਂ ਯੂਥ ਇਹਨਾਂ ਨੂੰ ਦੇਖ ਕੇ ਬਹੁਤ ਹੀ ਮਾੜਾ ਹੁੰਦਾ ਜਾ ਰਿਹਾ ਹੈ